ਜਦ ਮੈਂ ਦਸਵੀਂ ਜਮਾਤ ਦੇ ਪੇਪਰ ਦਿੱਤੇ ਤਾਂ ਮੇਰੇ ਵੀਰ ਜੀ ਨੇ ਮੈਨੂੰ ਇੱਕ ਨਾਵਲ ਲਿਆ ਕੇ ਦਿੱਤਾ ਨਾਵਲ ਦਾ ਨਾਂ ਸੀ ਅਸਲੀ ਮਨੁੱਖ ਦੀ ਵਾਰਤਾ ਇਹ ਰਸ਼ੀਅਨ ਨਾਵਲ ਸੀ ਅਤੇ ਪੰਜਾਬੀ 'ਚ ਅਨੁਵਾਦਿਤ ਸੀ ਉਸਦਾ ਇੱਕ ਪਾਤਰ ਸੀ ਜੋ ਕਿ ਜਹਾਜ਼ ਦਾ ਪਾਇਲਟ ਸੀ ਬਹੁਤ ਸੋਹਣਾ ਜਹਾਜ਼ ਚਲਾਉਂਦਾ ਸੀ ਪਰ ਬਦਕਿਸਮਤੀ ਨਾਲ ਕਿਸੇ ਕਾਰਨ ਉਸਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ ਹੌਸਪੀਟਲ ਵਿੱਚ ਉਸਦਾ ਕਾਫੀ ਇਲਾਜ ਚੱਲਿਆ ਨਕਲੀ ਲੱਤਾਂ ਨਾਲ ਉਹ ਚੱਲਣ ਫਿਰਨ ਲੱਗ ਪਿਆ ਪਰ ਉਸ ਦੀ ਜ਼ਿੱਦ ਸੀ ਕਿ ਮੈਂ ਦੁਬਾਰਾ ਜਹਾਜ਼ ਚਲਾਉਣਾ ਹੈ ਉਸਨੇ ਆਪਣੀ ਜ਼ਿੱਦ ਨਹੀਂ ਛੱਡੀ ਅਤੇ ਉਹ ਇਹ ਇਸ ਕੰਮ ਵਿੱਚ ਸਫਲ ਵੀ ਹੋਇਆ ਮੈਂ ਉਸ ਤੋਂ ਬਹੁਤ ਪ੍ਰਭਾਵਿਤ ਹੋਈ ਕਿ ਜੇ ਇੱਕ ਨਕਲੀ ਲੱਤਾਂ ਨਾਲ ਕੋਈ ਆਦਮੀ ਦੁਬਾਰਾ ਜਹਾਜ਼ ਚਲਾ ਸਕਦਾ ਹੈ ਤਾਂ ਅਸੀਂ ਕਿਹੜਾ ਕੰਮ ਨਹੀਂ ਕਰ ਸਕਦੇ ਕੋਈ ਕੰਮ ਮੁਸ਼ਕਲ ਨਹੀਂ ਹੁੰਦਾ ਇਸ ਤੋਂ ਮੈਂ ਬਹੁਤ ਪ੍ਰਭਾਵਿਤ ਹੋਈ ਧੰਨਵਾਦ ਮੈਂ ਕਿਸੇ ਵੀ ਰੀਡਿੰਗ ਕਲੱਬ ਵਿੱਚ ਸ਼ਾਮਿਲ ਨਹੀਂ ਹੋਈ ਪਰ ਮੈਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਬਹੁਤ ਹੈ ਮੇਰੇ ਘਰ ਵਿੱਚ ਬਹੁਤ ਸਾਰੀਆਂ ਕਿਤਾਬਾਂ ਹਨ ਜਿਨ੍ਹਾਂ ਨੂੰ ਮੈਂ ਸਮੇਂ ਸਮੇਂ ਪੜ੍ਹਦੀ ਰਹਿੰਦੀ ਹਾਂ ਧੰਨਵਾਦ